ਸਤਿ ਸ਼੍ਰੀ ਅਕਾਲ ਜੀ ਉਸ ਤਰ੍ਹਾਂ ਤਾਂ ਬਹੁਤ ਗੱਲਾਂ ਹਨ ਜਿਨ੍ਹਾਂ ਬਾਰੇ ਮੈਂ ਅੱਜ ਲਿਖਣਾ ਚਾਹੁੰਦੀ ਹਾਂ ਸਮਾਜ ਨੂੰ ਵੀ ਦੱਸਣਾ ਚਾਹੁੰਦੀ ਹਾਂ ਜਿਵੇਂ ਕਿ ਅੱਜ ਕੱਲ੍ਹ ਮੈਂ ਦੇਖ ਰਹੀ ਹਾਂ ਕਿ ਕਈ ਲੋਕ ਜੋ ਔਰਤਾਂ ਨੂੰ ਦਰਜਾ ਨਹੀਂ ਦਿੰਦੇ ਜਦ ਕਿ ਔਰਤ ਵੀ ਸਮਾਜ ਦਾ ਹਿੱਸਾ ਹਿੱਸਾ ਹੈ ਸਾਨੂੰ ਔਰਤਾਂ ਨੂੰ ਇੱਜ਼ਤ ਨਾਲ਼ ਬੁਲਾਉਣਾ ਕਵਾਉਣਾ ਚਾਹੀਦਾ ਹੈ ਉਹਨਾਂ ਦਾ ੳਨ ਉਹਨਾਂ ਦੀ ਇੱਜ਼ਤ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਵਧੇਰੇ ਪੜ੍ਹਨ ਦਾ ਮੌਕਾ ਦੇਣਾ ਚਾਹੀਦਾ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਲੋਕ ਕੁੜੀਆਂ ਨੂੰ ਵੀ ਬਾਰਵੀਂ ਦਸਵੀਂ ਕਰਵਾ ਕੇ ਘਰ ਬਿਠਾ ਦਿੰਦੇ ਹਨ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਕੁੜੀਆਂ ਨੂੰ ਵੀ ਅੱਜ ਕੱਲ੍ਹ ਮੁੰਡਿਆਂ ਦੇ ਬਰਾਬਰ ਅੱਗੇ ਵੱਧ ਰਹੀਆਂ ਹਨ ਇਸ ਲਈ ਇਸ ਕਰਕੇ ਸਾਨੂੰ ਕੁੜੀਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਹੋਰ ਵੀ ਮੈਂ ਇਸ ਵਿਸ਼ੇ 'ਤੇ ਲਿਖਣਾ ਚਾਹਵਾਂਗੀ ਕਿ ਸਾਨੂੰ ਗਲਤ ਕੰਮਾਂ ਵਿੱਚ ਨਹੀਂ ਪੈਣਾ ਚਾਹੀਦਾ ਦੇਖਿਆ ਜਾਵੇ ਤਾਂ ਲੋਕ ਗਲਤ ਗੱਲਾਂ ਵਿੱਚ ਆ ਕੇ ਮਾੜਾ ਸੋਚਦੇ ਹਨ ਸਾਨੂੰ ਉਹ ਨਹੀਂ ਕਰਨਾ ਚਾਹੀਦਾ ਦੂਸਰਿਆਂ ਦਾ ਹਮੇਸ਼ਾਂ ਭਲਾ ਕਰਨਾ ਚਾਹੀਦਾ ਹੈ ਸਾਨੂੰ ਆਪਣੀ ਇਨਸਾਨੀਅਤ ਵੀ ਦਿਖਾਉਣੀ ਚਾਹੀਦੀ ਹੈ ਕਿਸੇ ਨਾਲ਼ ਸਾਨੂੰ ਮਾੜਾ ਚੰਗਾ ਬੋਲ ਨਹੀਂ ਬੋਲਣਾ ਚਾਹੀਦਾ ਜੇਕਰ ਸਾਨੂੰ ਲੱਗਦਾ ਹੈ ਕਿ ਕੋਈ ਇਨਸਾਨ ਮੁਸੀਬਤ ਵਿੱਚ ਹੈ ਉਸ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਆਮ ਆਦਮੀ ਦਾ ਫਰਜ਼ ਹੈ ਕਿ ਉਹ ਦੂਸਰੇ ਇਨਸਾਨ ਦੀ ਮੁਸੀਬਤ ਵਿੱਚ ਮਦਦ ਕਰੇ ਕਹਿੰਦੇ ਹਨ ਕਿ ਭਲਾ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਅਤੇ ਕੁਝ ਮੈਂ ਵਾਤਾਵਰਨ ਬਾਰੇ ਵੀ ਦੱਸਣਾ ਚਾਹਵਾਂਗੀ ਸਾਨੂੰ ਆਪਣਾ ਵਾਤਾਵਰਨ ਸ਼ੁੱਧ ਰੱਖਣਾ ਚਾਹੀਦਾ ਹੈ ਜੇਕਰ ਸਾਡਾ ਵਾਤਾਵਰਨ ਸਾਫ਼ ਸੁਥਰਾ ਰਹੇਗਾ ਤਾਂ ਅਸੀਂ ਵੀ ਤੰਦਰੁਸਤ ਰਹਾਂਗੇ ਧੰਨਵਾਦ ਜੀ